ਪੰਜਾਬ ਉਹਦੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਜੋ ਹੈ ਪੰਜਾਬ ਦੀ ਮਾਂ ਬੋਲੀ ਕਹੀ ਜਾਂਦੀ ਹੈ ਲੇਕਿਨ ਉਹ ਸਿਰਫ ਪੰਜਾਬ ਦੇ ਵਿੱਚ ਹੀ ਬੋਲੀ ਜਾਂਦੀ ਹੈ ਜੇਕਰ ਅਸੀਂ ਪੰਜਾਬ ਤੋਂ ਬਾਹਰ ਜਾਈਏ ਤਾਂ ਅਸੀਂ ਜੇ ਆਪਣੀ ਪੰਜਾਬੀ 'ਚ ਗੱਲ ਕਰਦੇ ਹਾਂ ਅਤੇ ਬਾਹਰ ਦੇ ਲੋਕਾਂ ਨੂੰ ਜਿਵੇਂ ਮੰਨ ਲਉ ਕਿ ਅਸੀਂ ਦਿੱਲੀ ਚਲੇ ਜਾਈਏ ਗੁਜਰਾਤ ਚਲੇ ਜਾਈਏ ਅਤੇ ਉਹਨਾਂ ਲੋਕਾਂ ਨੂੰ ਸਾਡੀ ਭਾਸ਼ਾ ਸਮਝ ਨਹੀਂ ਆਏਗੀ ਉੱਥੇ ਜੇਕਰ ਹਿੰਦੀ ਬੋਲਾਂਗੇ ਅਤੇ ਉਹਨਾਂ ਨੂੰ ਸਮਝ ਆਏਗੀ ਪੰਜਾਬੀ ਉਹਨਾਂ ਨੂੰ ਸਮਝ ਨਹੀਂ ਆਏਗੀ ਕਿਉਂਕਿ ਪੰਜਾਬ ਪੰਜਾਬੀ ਪੰਜਾਬ ਦੇ ਵਿੱਚ ਹੀ ਬੋਲੀ ਜਾਂਦੀ ਹੈ ਅਤੇ ਜੇ ਮੈਂ ਉਹਨਾਂ ਨਾਲ ਗੱਲਬਾਤ ਹਿੰਦੀ ਭਾਸ਼ਾ 'ਚ ਕਰਾਂਗੀ ਤਾਂ ਉਹਨਾਂ ਨੂੰ ਜ਼ਿਆਦਾ ਵਧੀਆ ਸਮਝ ਆਏਗੀ ਜਿਸ ਤਰ੍ਹਾਂ ਕਿ ਅਸੀਂ ਸਮਝ ਲਉ ਕਿ ਮੈਂ ਗੁਜਰਾਤ ਜਾ ਰਹੀ ਹਾਂ ਜਾਂ ਦਿੱਲੀ ਜਾ ਰਹੀ ਹਾਂ ਮੈਂ ਉਹਨਾਂ ਕੋਲ ਰਸਤਾ ਪੁੱਛਣਾ ਹੈ ਕੁਛ ਪੁੱਛਣਾ ਹੈ ਅਤੇ ਉਹਨਾਂ ਕੋਲ ਉਹ ਮੈਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਮੇਰੀ ਗੱਲ ਸਮਝ ਹੀ ਨਹੀਂ ਆਏਗੀ ਹਾਂ ਜੇਕਰ ਮੈਂ ਹਿੰਦੀ ਭਾਸ਼ਾ 'ਚ ਬੋਲਾਂਗੀ ਤਾਂ ਉਹਨਾਂ ਨੂੰ ਮੇਰੀ ਗੱਲ ਚੰਗੇ ਤਰੀਕੇ ਦੇ ਨਾਲ ਸਮਝ ਆਏਗੀ ਅਤੇ ਉਹ ਮੈਨੂੰ ਚੰਗੇ ਤਰੀਕੇ ਨਾਲ ਗਾਈਡ ਕਰ ਸਕਣਗੇ ਇਸ ਲਈ ਅਸੀਂ ਜੋ ਹੈ ਪੰਜਾਬੀ ਭਾਸ਼ਾ ਦੇ ਨਾਲੋਂ ਜੋ ਹਿੰਦੀ ਭਾਸ਼ਾ ਹੈ ਉਹ ਸਾਡੀ ਰਾਸ਼ਟਰ ਭਾਸ਼ਾ ਹੈ ਉਹ ਸਾਰੀ ਦੇਸ਼ ਦੇ ਵਿੱਚ ਸ ਈ ਸਾਰੀ ਹਿੰਦੁਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਅਤੇ ਇਸ ਲਈ ਸਾਨੂੰ ਹਿੰਦੀ ਵੀ ਆਉਣੀ ਬਹੁਤ ਜ਼ਰੂਰੀ ਹੈ ਉਹ ਹਿੰਦੀ ਸਾਨੂੰ ਸ਼ੁਰੂ ਤੋਂ ਸਾਡੇ ਸਕੂਲਾਂ ਦੇ ਵਿੱਚ ਸਿਖਾਈ ਵੀ ਜਾਂਦੀ ਹੈ ਇਸ ਲਈ ਕਿ ਅਸੀਂ ਬਾਹਰ ਜਾ ਕੇ ਆਪਣੀ ਗੱਲਬਾਤ ਅਰਾਮ ਦੇ ਨਾਲ ਕਿਸੇ ਹੋਰ ਲੋਕਾਂ ਦੇ ਨਾਲ ਲੋ ਲੋਕਾਂ ਨੂੰ ਸਮਝਾ ਸਕੀਏ